ਮੈਨੂੰ ਕੈਮਰੇ ਨਾਲ ਬਹੁਤ ਜੀ ਤਸਵੀਰਾਂ ਖਿੱਚਣੀਆਂ ਚੰਗੀਆਂ ਲੱਗਦੀਆਂ ਹਨ ਜਿਵੇਂ ਕਿ ਮੇਰੀਆਂ ਖੁੱਦ ਦੀਆਂ ਫੁੱਲਾਂ ਦੀਆਂ ਨੇਚਰ ਦੀਆਂ ਅਸਮਾਨ ਦੀਆਂ ਬਹੁਤ ਸਾਰੀਆਂ ਤਸਵੀਰਾਂ ਮੈਨੂੰ ਖਿੱਚਣੀਆਂ ਬਹੁਤ ਚੰਗਾ ਲੱਗਦੀਆਂ ਹਨ ਜਿਵੇਂ ਹੁਣ ਮੈਂ ਕਿਤੇ ਘੁੰਮਣ ਜਾਂਦੀ ਆ ਤਾਂ ਮੈਨੂੰ ਪਹਾੜਾਂ ਦੀ ਤਸਵੀਰਾਂ ਖਿੱਚਣੀਆਂ ਬਹੁਤ ਚੰਗੀਆਂ ਲੱਗਦੀਆਂ ਪਹਾੜਾਂ ਦੇ ਵਿੱਚ ਵੀਡੀਓ ਬਣਾਉਣਾ ਅਤੇ ਆਪਦੇ ਜਦੋਂ ਮੈਂ ਕੋਈ ਪਾਰਟੀ ਵਗੈਰਾ ਕਰਦੇ ਉਹਦੇ ਵਿੱਚ ਆਪਣੀਆਂ ਤਸਵੀਰਾਂ ਅਤੇ ਆਪਣੇ ਨਾਲ ਦੇ ਦੋਸਤਾਂ ਰਿਸ਼ਤੇਦਾਰਾਂ ਦੀ ਤਸਵੀਰ ਖਿੱਚਣ ਵਿੱਚ ਮੈਨੂੰ ਬਹੁਤ ਹੀ ਆਨੰਦ ਆਉਂਦਾ ਕਿਉਂਕਿ ਤਸਵੀਰਾਂ ਇੱਕ ਮੈਮਰੀ ਬਣ ਜਾਂਦੀ ਹੈ ਉਸ ਕਾਰਨ ਜਿਸ ਮੈਨੂੰ ਬਾਅਦ ਵਿੱਚ ਦੇਖ ਕੇ ਉਹਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਜਿਹੜੀਆਂ ਤਸਵੀਰਾਂ ਉਹ ਸਾਡੇ ਵਾਸਤੇ ਇੱਕ ਯਾਦ ਦੇ ਤੌਰ 'ਤੇ ਰਹਿ ਜਾਂਦੀਆਂ ਹਨ ਜੇ ਯਾਦ ਤਸਵੀਰਾਂ ਅਸੀਂ ਕਦੇ ਵੀ ਦੇਖ ਸਕਦੇ ਹਾਂ ਅਤੇ ਉਹਦੇ ਨਾਲ ਸਾਨੂੰ ਉਹ ਉਹੀ ਸਥਿਤੀ ਅਸੀਂ ਵਾਪਸ ਤੋਂ ਮਹਿਸੂਸ ਕਰ ਸਕਦੇ ਹਾਂ ਜਿਹੜੀ ਤਸਵੀਰਾਂ ਨਾਲ ਸਾਡਾ ਇੱਕ ਲਗਾਵ ਹੁੰਦਾ ਹੈ ਜਿਸ ਕਰਕੇ ਅਸੀਂ ਬਹੁਤ ਹੀ ਚੰਗਾ ਮਹਿਸੂਸ ਕਰਦੇ ਹਾਂ ਅਤੇ ਰਹੀ ਗੱਲ ਪ੍ਰਕਿਰਤੀ ਦੀ ਤਸਵੀਰਾਂ ਖਿੱਚਣ ਦੀ ਉਹ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਜਿਵੇਂ ਜਾਨਵਰਾਂ ਦੀ ਤਸਵੀਰਾਂ ਅਤੇ ਫੁੱਲਾਂ ਦੀ ਤਸਵੀਰਾਂ ਜਾਂ ਫਿਰ ਪਹਾੜ ਨਦੀਆਂ ਦੀ ਤਸਵੀਰਾਂ ਇਹ ਮੈਨੂੰ ਬਹੁਤ ਹੀ ਜ਼ਿਆਦਾ ਚੰਗੇ ਲੱਗਦੇ ਹਨ ਕੁਦਰਤ ਤਾਂ ਬਹੁਤ ਪ੍ਰੇ ਮੈਂ ਕੁਦਰਤ ਦੀ ਬਹੁਤ ਵੱਡੀ ਪ੍ਰੇਮੀ ਹਾਂ ਜਿਸ ਕਰਕੇ ਮੈਨੂੰ ਕੁਦਰਤ ਨੂੰ ਮਹਿਸੂਸ ਕਰਨਾ ਹਰ ਪਲ ਉਹਦੇ ਅੰਗ ਸੰਗ ਰਹਿਣਾ ਬਹੁਤ ਹੀ ਜ਼ਿਆਦਾ ਚੰਗਾ ਲੱਗਦਾ ਹੈ ਕੁਦਰਤ ਨਾਲ ਜੁੜ੍ਹੇ ਰਹਿਣ ਨਾਲ ਵੀ ਮੈਂ ਆਪਦੇ ਫੋਨ ਵਿੱਚ ਉਹ ਤਸਵੀਰਾਂ ਨੂੰ ਖਿੱਚਦੀ ਹਾਂ ਅਤੇ ਉਹਨੂੰ ਬਾਰ ਬਾਰ ਦੇਖਦੀ ਹਾਂ ਅਤੇ ਮੈਨੂੰ ਉਹ ਬਹੁਤ ਚੰਗਾ ਲਗਦਾ ਹੈ